ਤਰਨ ਤਾਰਨ ਜ਼ਿਲ੍ਹਾ ਇੱਕ ਧਾਰਮਿਕ ਸਥਾਨ ਹੈ ਇੱਥੇ ਦੂਰੋਂ ਦੂਰੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਇੱਥੋਂ ਦਾ ਮੁੱਖ ਕੱਪੜਾ ਉਦਯੋਗ ਹੈ ਇੱਥੇ ਕਿਰਪਾਨਾਂ ਵੀ ਬਣਾਈਆਂ ਜਾਂਦੀਆਂ ਹਨ ਜੋ ਕਿ ਵੱਡੇ ਪੱਧਰ 'ਤੇ ਇੱਥੇ ਖਰੀਦਦਾਰੀ ਵੀ ਹੁੰਦੀ ਹੈ ਇੱਥੇ ਖਾਦ ਫੈਕਟਰੀਆਂ ਵੀ ਹਨ ਇੱਥੇ ਕੱਪੜਾ ਬਣਾਉਣ ਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਵੀ ਹਨ ਤਰਨ ਤਾਰਨ ਵਿੱਚ ਕਈ ਛੋਟੇ ਅਤੇ ਵੱਡੇ ਪੈਮਾਨੇ ਦੇ ਉਦਯੋਗ ਹਨ ਤਰਨ ਤਾਰਨ ਜ਼ਿਲ੍ਹੇ ਵਿੱਚ ਕਈ ਫੈਕਟਰੀਆਂ ਹਨ ਜਿਵੇਂ ਏਸ਼ੀਆ ਦਾ ਸਭ ਤੋਂ ਵੱਡਾ ਪੋਲਟਰੀ ਫਾਰਮ ਇੱਥੇ ਹੈ ਇੱਥੇ ਰਾਈਸ ਸ਼ੈਲਰ ਹਨ ਪਿੰਡ ਲਹੋਕਾ ਵਿਖੇ ਪ੍ਰਮੁੱਖ ਸ਼ਰਾਬ ਫੈਕਟਰੀ ਹੈ ਇਸ ਸ਼ਰਾਬ ਫੈਕਟਰੀ ਦੀ ਵਿਕਰੀ ਬਹੁਤ ਜ਼ਿਆਦਾ ਹੈ ਅਤੇ ਬਹੁਤ ਹੀ ਵੱਡੇ ਪੱਧਰ 'ਤੇ ਇੱਥੇ ਸ਼ਰਾਬ ਵਿਕਦੀ ਹੈ ਇੱਥੇ ਸ਼ੂਗਰ ਮਿੱਲ ਵੀ ਹੈ ਵਿਸ਼ਵ ਪ੍ਰਸਿੱਧ ਮੱਛੀ ਬਾਜ਼ਾਰ ਹਰੀਕੇ ਵਿੱਚ ਹੈ ਜੋ ਕਿ ਇਸ ਦੀ ਅਰਥ ਵਿਵਸਥਾ ਦੇ ਚਾਲਕ ਹਨ